ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਸੁਣਾਓ ਅੱਛਾ ਜੀ ਅੱਛਾ ਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਮੈਂ ਦੇਖਿਆ ਹੀ ਨੀ ਤੁਹਾਨੂੰ ਦੇਖ ਲੈਂਦੀ ਤਾਂ ਕਦੇ ਮੇਰੇ ਆਪਾਂ ਮਿਲ ਪੈਂਦੇ ਆ ਇੱਕ ਦੂਸਰੀ ਨੂੰ ਬਸ ਬਾਹਰ ਨਹੀਂ ਨਾ ਮੈਂ ਨਿਕਲੀ ਬਾਹਰ ਨਿਕਲਦੀ ਤਾਂ ਪਤਾ ਲੱਗ ਜਾਂਦਾ ਹਾਂਜੀ ਅੱਛਾ ਜੀ ਅੱਛਾ ਤੁਸੀਂ ਕਿੱਥੋਂ ਲਿਆਏ ਸਬਜ਼ੀ ਅੱਗੇ

ਅੱਛਾ ਆਪਣੇ ਵਧੀਆ ਦੁਕਾਨਾਂ ਹੈਗੀਆਂ ਤਾਜ਼ੀਆਂ ਸਬਜ਼ੀਆਂ ਦੁਕਾਨਾਂ ਤੋਂ ਵੀ ਮਿਲ ਜਾਂਦੀਆਂ ਨੇ ਬਹੁਤ ਵਧੀਆ ਮਿਲਦੀਆਂ ਨੇ ਹਾਂਜੀ ਅਤੇ ਉਹ ਨਾ ਇੱਕ ਹੈਗੀ ਉਹ ਗੋਬਰ ਮੰਡੀ ਵੱਲੇ ਵੀ ਦੁਕਾਨਾਂ ਬਹੁਤ ਵਧੀਆ ਦੁਕਾਨਾਂ ਤੋਂ ਸਬਜ਼ੀਆਂ ਹਰੇਕ ਮਿਲ ਜਾਂਦੀਆਂ ਉੱਥੇ ਜਾ ਕੇ ਵੇਖੋ ਤੁਸੀਂ ਭਲਾ ਹਾਂਜੀ ਹਾਂਜੀ ਹਾਂਜੀ ਉਹ ਇਹ ਜਿਹੜੀ ਮੰਡੀ ਹੈ ਨਾ ਆਪਣੀ ਸਬਜ਼ੀ ਮੰਡੀ ਉੱਥੇ ਤਾਂ ਸੁਬਹਾ ਹੀ ਜਾਣਾ ਪੈਂਦਾ ਤੜਕੇ ਜਾਣਾ ਪੈਂਦਾ ਪੰਜ ਕੁ ਵਜੇ ਪਰ ਧੁੰਦਾ ਧੰਦਾ ਹੁੰਦੀਆਂ ਨੇ ਅਤੇ ਵੇਖ ਲਓ ਜੇ ਤੁਸੀਂ ਜਾ ਸਕਦੇ ਤਾਂ

ਤਾਂ ਵੇ ਹਾਂਜੀ ਵੇਖ ਲਓ ਫਿਰ ਉੱਥੇ ਸੰਦ 'ਤੇ ਹੀ ਜਾਣਾ ਪੈਣਾ ਨਾ ਉਹ ਥੋੜ੍ਹਾ ਜਿਹਾ ਦੂਰ ਪੈ ਜਾਂਦੀ ਅੱਛਾ ਜੀ ਮੈਂ ਤਾਂ ਫਿਰ ਅੱਗੇ ਤਾਂ ਜਾਂਦੀ ਹਾਂ ਚਲ ਜਾਂਦੇ ਤਾਂ ਰੋਜ਼ ਹੀ ਅਸੀਂ ਦੁਕਾਨ ਤੋਂ ਵੀ ਲੈ ਆਈ ਦੀ ਸਬਜ਼ੀ ਤਾਂ ਵਧੀਆ ਮਿਲਦੀਆਂ ਨੇ ਸ਼ਾਮ ਨੂੰ ਜਾਈਦਾ ਸੱਤ ਕੁ ਵਜੇ ਸੱਤ ਸਾਢੇ ਸੱਤ ਅਤੇ ਘੱਟ ਰੇਟ 'ਤੇ ਮਿਲ ਜਾਂਦੀਆਂ ਨੇ ਅਤੇ ਜੇ ਤੁਸੀਂ ਜੇ ਦੁਕਾਨ ਤੋਂ ਵੇਖਣੀਆਂ ਨੇ ਤਾਂ ਤੁਸੀਂ ਫਿਰ ਅੱਜ ਦੁਕਾਨ ਤੋਂ ਲੈ ਕੇ ਵੇਖ ਲਓ ਇੱਕ ਵਾਰ ਹਾਂ ਅਤੇ ਅੱਜ ਨਾ ਹਾਡੇ ਨਾ ਭੈਣ ਜੀ ਪਤਾ ਕੀ ਪਰਾਉਣੇ ਆਉਣੇ ਨੇ ਤਾਂ ਇਸ ਕਰਕੇ ਮੈਂ ਸਬਜ਼ੀ ਲੈਣ ਜਾਣਾ ਥੋੜ੍ਹਾ ਜਿਹਾ ਅੱਜ ਮੈਨੂੰ ਤਾਂ ਚਾਰ ਕੁ ਵਜੇ ਜਾਣਾ ਪੈ ਜਾਣਾ ਹਾਂਜੀ ਜੇ ਤੁਸੀਂ ਜੇ ਤੁਸੀਂ ਜਾਣਾ ਜੇ ਨਾ ਚਾਰ ਵਜੇ ਤਿਆਰ ਹੋ ਕੇ ਮੇਰੇ ਘਰ ਆ ਜਾਣਾ ਹਾਂਜੀ ਮੈਂ ਅਤੇ ਜ਼ਿਆਦਾ ਲੇਟ ਨਾ ਕਰਿਆ ਜੇ ਚ ਚਲੋ ਆ ਜਿਓ ਨਾਲ ਚਾਹ ਪਾਣੀ ਪੀ ਲਿਆ ਜੇ ਹਾਂ ਅੱਛਾ ਜੀ ਅਤੇ ਕਿੱਥੇ ਰਹਿੰਦੇ ਸੀ ਭੈਣ ਜੀ ਤੁਸੀਂ ਪਹਿਲਾਂ ਅੱਛਾ ਉੱਥੋਂ ਕਿਉਂ ਆ ਗਏ ਸਿਫਟ ਕਿਉਂ ਹੋ ਗਏ ਕੀ ਗੱਲ ਆਪਣਾ ਮਕਾਨ ਸੀ ਅੱਛਾ ਅੱਛਾ ਕਿਰਾਏ 'ਤੇ ਸੀ ਅੱਛਾ ਜੀ ਅੱਛਾ ਹਾਂਜੀ ਹਾਂਜੀ ਉਹ ਤਾਂ ਹੋ ਜਾਂਦਾ ਨਾ ਨਵਾਂ ਬੰਦਾ ਆਇਆ ਹੋਵੇ ਨਾ ਜਦੋਂ ਤਾਂ ਫਿਰ ਨਹੀਂ ਸਮਝ ਆਉਂਦੀ ਦੂਸਰੇ ਸ਼ਹਿਰ ਦੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਕੋਈ ਚਿੰਤਾ ਨਾ ਕਰਿਆ ਕਰੋ ਤੁਸੀਂ ਆ ਜਾਇਆ ਕਰੋ ਫਿਰ ਘਰ ਤਾਂ ਮੈਂ ਤੁਹਾਡੇ ਨਾਲ ਚੱਲ ਫਿਰਿਆ ਕਰਾਂਗੀ ਹਾਂਜੀ ਹਾਂਜੀ ਅੱਜ ਚਾਰ ਵਜੇ ਆ ਜਾਇਆ ਜੇ ਕਿਉਂਕਿ ਸਬਜ਼ੀ ਸੁਬਜ਼ੀ ਕੱਲ ਤੋਂ ਆਪਾਂ ਲੇਟ ਜਾਇਆ ਕਰਾਂਗੇ ਫਿਰ ਪਰਾਹੁਣੇ ਚਲੇ ਜਾਣਗੇ ਨਾ ਸੱਤ ਵਜੇ ਚਲ ਗਏ ਜਦੋਂ ਵੀ ਟਾਈਮ ਤੁਹਾਡਾ ਹੋਇਆ ਉਦੋਂ ਆਪਾਂ ਚਲ ਜਾਇਆ ਕਰਾਂਗੇ ਨਾਲ ਸ਼ਾਮ ਨੂੰ ਸਬਜ਼ੀ ਵਧੀਆ ਮਿਲ ਜਾਂਦੀ ਹਾਂਜੀ ਘੱਟ ਰੇਟ 'ਤੇ ਅੱਛਾ ਜੀ ਹਾਂਜੀ ਛੇਤੀ ਆਇਆ ਜੇ ਥੋੜ੍ਹਾ ਟਾਈਮ ਨਾ ਲਾਇਆ ਜੇ ਹਾਂਜੀ ਉਹ ਤਾਂ ਗੱਲ ਠੀਕ ਹੈ ਤੁਹਾਡੀ ਪਰ ਕਈ ਵਾਰ ਨਾ ਤਿਆਰ ਵੀ ਹੁੰਦਿਆ ਹੁੰਦਿਆ ਟਾਈਮ ਜ਼ਿਆਦਾ ਲੱਗ ਜਾਏ ਫਿਰ ਮੈਨੂੰ ਔਖਾ ਜਾਣਾ ਮੈਂ ਉਹਨਾਂ ਦੇ ਆਉਂਦਿਆਂ ਨੂੰ ਸਬਜ਼ੀ ਤਿਆਰ ਕਰਨੀ ਕੋਈ ਗੱਲ ਨਹੀਂ ਤੁਸੀਂ ਇੰਝ ਕਰੋ ਚਾਹ ਪਾਣੀ ਆਪਾਂ ਬਾਅਦ 'ਚ ਭੈਣਜੀ ਪੀ ਲਵਾਂਗੇ ਅਤੇ ਆ ਜਾਇਓ ਤੁਸੀਂ ਇਧਰ ਮੇਰੇ ਵੱਲੇ ਹੀ ਆ ਜਾਇਓ ਅਤੇ ਆਪਾਂ ਇਧਰਲੀ ਗਲੀ ਨਿਕਲ ਜਾਵਾਂਗੇ ਆਹ ਸਾਡਾ ਸਾ ਘਰ ਨੇੜੇ ਹੀ ਨਾਲ ਹੀ ਹਾਂਜੀ ਅੱਛਾ ਜੀ ਕੋਈ ਗੱਲ ਨਹੀਂ ਆਪਾਂ ਘਰ ਵੇਖ ਲਵਾਂਗੇ ਹੁਣ ਭੈਣਾਂ ਬਣ ਗਈਆਂ ਅਤੇ ਇੱਕ ਦੂਜੇ ਦੇ ਘਰ ਜਾਇਆ ਆਇਆ ਕਰਾਂਗੀਆਂ ਅਤੇ ਤੁਸੀਂ ਹੁਣ ਇੱਕ ਵਾਰ ਜਲਦੀ ਆ ਜਾਓ ਤਿਆਰ ਹੋ ਕੇ ਇਹ ਥੈਲਾ ਭੈਣ ਜੀ ਲੈ ਕੇ ਆਇਆ ਜੇ ਕਿਉਂਕਿ ਉਹ ਲਿਫਾਫਾ ਨਹੀਂ ਦਿੰਦੇ ਇਸ ਕਰਕੇ ਥੈਲੇ 'ਚ ਆਪਣੇ 'ਚ ਪਾਉਣੀ ਪੈਂਦੀ ਸਬਜ਼ੀ ਹਾਂਜੀ ਹਾਂਜੀ ਅਤੇ ਇਸ ਕਰਕੇ

ਅੱਛਾ ਭੈਣ ਜੀ ਜਾਂ ਹਾਂਜੀ ਹਾਂਜੀ ਓਕੇ ਬਾਏ ਜਲਦੀ ਆ ਜਾਓ ਬਸ